ਪੰਛੀ ਕਾਫੀ ਤਰ੍ਹਾਂ ਦੇ ਹੁੰਦੇ ਹਨ ਸਾਡੇ ਖੇਤਰ ਵਿੱਚ ਜ਼ਿਆਦਾਤਰ ਮੋਰ ਚਿੜੀਆਂ ਜਿਨ੍ਹਾਂ ਦਾ ਰੰਗ ਭੂਰਾ ਹੁੰਦਾ ਹੈ ਜਿਨ੍ਹਾਂ ਨੂੰ ਘਰੇਲੂ ਚਿੜੀਆਂ ਵੀ ਕਿਹਾ ਜਾਂਦਾ ਹੈ ਉੱਲੂ ਕਾਂ ਕੂੰਜ ਕਮਾਦੀ ਕੁੱਕੜ ਕਾਲਾ ਤਿੱਤਰ ਪਪੀਹਾ ਮੁਰਗਾਬੀ ਤੋਤੇ ਕਬੂਤਰ ਘੁੱਗੀ ਕੋਇਲ ਜਿਸ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ ਬਟੇਰ ਇੱਦਾਂ ਦੇ ਪੰਛੀ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਮੇਰਾ ਪਸੰਦੀਦਾ ਪੰਛੀ ਮੋਰ ਹੈ ਜੋ ਕਿ ਸੋਹਣਾ ਹੁੰਦਾ ਹੈ ਅਤੇ ਪਿੰਡਾਂ ਦੇ ਖੇਤਾਂ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲ ਜਾਂਦਾ ਹੈ